ਅਸੀਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਹੋਟਲਾਂ ਅਤੇ ਢਾਬਿਆਂ ਵਿੱਚ ਜਾਣਾ ਪਸੰਦ ਨਹੀਂ ਕਰਦੇ ਇੰਨਾਂ ਪਰ ਫਿਰ ਵੀ ਕਈ ਚੀਜ਼ਾਂ ਦੀ ਘਰ ਵਿੱਚ ਆਪਾਂ ਠੀਕ ਢੰਗ ਨਾਲ ਠੀਕ ਚੀਜ਼ਾਂ ਪ ਪ੍ਰੋਪਰ ਚੀਜ਼ਾਂ ਨਾ ਹੋਣ ਕਰਕੇ ਅਤੇ ਨਾਲ ਨਹੀਂ ਬਣਾ ਸਕਦੇ ਅਤੇ ਕਈਆਂ ਚੀਜ਼ਾਂ ਨੂੰ ਘਰ ਬਣਨ 'ਤੇ ਵੀ ਬਹੁਤ ਟਾਈਮ ਲੱਗਦਾ ਹੈ ਅਤੇ ਉਹਨਾਂ ਨੂੰ ਆਪਾਂ ਬਾਹਰ ਹੋਟਲਾਂ ਅਤੇ ਢਾਬਿਆਂ ਉੱਤੇ ਖਾਣਾ ਪਸੰਦ ਕਰਦੇ ਹਾਂ ਜਿਵੇਂ ਕਿ ਅੰਮ੍ਰਿਤਸਰ ਦੇ ਕੁਲਚੇ ਬਹੁਤ ਹੀ ਪ੍ਰਸਿੱਧ ਹਨ ਜਿਸ ਜਿੱਥੋਂ ਜਿਸਨੂੰ ਖਾਣ ਲਈ ਲੋਕ ਦੂਰ ਦੂਰ ਤੋਂ ਆਉਂਦੇ ਹਨ ਨਾਲੇ ਕੁਲਚੇ ਵਗੈਰਾ ਬਣਾਉਣ ਲਈ ਇੱਕ ਤੰਦੂਰ ਚਾਹੀਦਾ ਹੁੰਦਾ ਹੈ ਜਿਸ ਨੂੰ ਆਪਾਂ ਘਰ ਦੇ ਵਿੱਚ ਆਪਾਂ ਉਸਦੀ ਵਿਵਸਥਾ ਠੀਕ ਢੰਗ ਨਾਲ ਨਹੀਂ ਕਰ ਸਕਦੇ ਪਹਿਲੇ ਜ਼ਮਾਨੇ ਵਿੱਚ ਛੋਟੇ ਛੋਟੇ ਤੰਦੂਰ ਹੁੰਦੇ ਸਨ ਪਰ ਹੁਣ ਉਹਨਾਂ ਤੰਦੂਰਾਂ ਦੀ ਵਰਤੋਂ ਹਰ ਇੱਕ ਗ੍ਰਹਿਣੀ ਨੂੰ ਨਹੀਂ ਆਉਂਦੀ ਇਸ ਲਈ ਅਸੀਂ ਆਪਣੇ ਕਿਸ ਕਦ ਕਦੇ ਕਤਾਈਂ ਆਪਾਂ ਬਾਹਰ ਆਪਣੇ ਹੋਟਲ ਅਤੇ ਢਾਬਿਆਂ 'ਚ ਜਾਂਦੇ ਹਾਂ ਜਿੱਥੇ ਕਿ ਆਪਾਂ ਆਪਣਾ ਮਨ ਪਸੰਦ ਨਾਨ ਕੁਲਚਾ ਵਗੈਰਾ ਆਪਾਂ ਆਪਣੀ ਮਨ ਪਸੰਦ ਦਾ ਖਾ ਸਕਦੇ ਹਾਂ